ਦੋ ਹਜ਼ਾਰ ਚਾਰ ਦੀ ਗੱਲ ਹੈ ਜਦੋਂ ਲੁਧਿਆਣੇ ਅਸੀਂ ਫੁੱਟਬਾਲ ਦਾ ਮੈਚ ਖੇਡਣ ਗਏ ਪੂਰਾ ਮੈਚ ਖੇਲਿਆ ਕੋਈ ਗੋਲ ਨਾ ਉਨ੍ਹਾਂ ਦੀ ਟੀਮ ਨੇ ਸਾਡੇ ਵੱਲ ਕੀਤਾ ਨਾ ਅਸੀਂ ਉਨ੍ਹਾਂ ਵੱਲ ਕੀਤਾ ਜਦੋਂ ਸੈਕਿੰਡ ਹਾਫ ਸ਼ੁਰੂ ਹੋਇਆ ਤੋ ਉਸ ਸਮੇਂ ਦੋਨੇ ਟੀਮਾਂ ਰਲ ਕੇ ਖੇਡਦੀਆਂ ਰਹੀਆਂ ਕੋਈ ਗੋਲ ਨਹੀਂ ਹੋਇਆ ਜਦ ਲਾਸਟ ਟਾਇਮ ਦੇ ਵਿੱਚ ਦੋ ਪਲੰਟੀਆਂ ਮਿਲੀਆਂ ਜੋ ਕਿ ਮੈਂ ਪਲੰਟੀਆਂ ਲਾਈਆਂ ਜਿਹਦੇ ਕਾਰਨ ਗੋਲ ਹੋ ਗਿਆ ਸਾਰੀ ਟੀਮ ਨੂੰ ਮੇਰੇ 'ਤੇ ਬਹੁਤ ਮੈਂ ਮਾਣ ਮਹਿਸੂਸ ਹੋਇਆ ਅਸੀਂ ਉਹ ਮੈਚ ਜਿੱਤ ਕੇ ਆਪਣੇ ਘਰ ਆਏ ਸਾਡੇ ਮੇਰੇ ਪਰਿਵਾਰ ਨੂੰ ਬਹੁਤ ਜ਼ਿਆਦਾ ਸਾਡੇ 'ਤੇ ਮੇਰੇ 'ਤੇ ਮਾਣ ਮਹਿਸੂਸ ਹੋਇਆ